ਪੰਜਾਬ ਵਿਚ ਅੱਜ ਵੀ ਬਹੁਤ ਸਾਰੇ ਪਿੰਡ ਅਜਿਹੇ ਵੀ ਹੈ ਜਿੱਥੇ ਅੱਜ ਵੀ ਬਾਥਰੂਮਾਂ ਜਾਂ ਟੋਇਲਟਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਟੋਇਲਟ ਅਤੇ ਬਾਥਰੂਮ ਉਪਲਬਧ ਹੀ ਨਹੀਂ ਹੁੰਦੇ ਹਨ ਪੰਜਾਬ ਸਰਕਾਰ ਨੇ ਇਸ ਲਈ ਬਹੁਤ ਸਾਰੇ ਪਬਲਿਕ ਟੋਇਲਟ ਵੀ ਬਣਾਏ ਹਨ ਜਿਸ ਕਾਰਨ ਬਿਮਾਰੀਆਂ ਨੂੰ ਬਚਣ ਤੋਂ ਫੈਲਿਆ ਜਾਵੇ ਫੈਲਣ ਤੋਂ ਬਚਿਆ ਜਾਵੇ ਅਤੇ ਲੋਕਾਂ ਨੂੰ ਸੁਰੱਖਸ਼ਿਤ ਰੱਖਿਆ ਜਾਵੇ ਅੱਜ ਕਿਉਂਕਿ ਬਿਮਾਰੀਆਂ ਗੰਦਗੀ ਨਾਲ ਹੀ ਫੈਲਦੀਆਂ ਹਨ ਅੱਜ ਕੱਲ੍ਹ ਪੰਜਾਬ ਵਿੱਚ ਬਹੁਤ ਜ਼ਿਆਦਾ ਤਰੱਕੀ ਹੋ ਚੁੱਕੀ ਹੈ ਜਿਸ ਕਾਰਨ ਕਿ ਲੋਕ ਅੱਜ ਆਪਣੇ ਘਰਾਂ ਵਿੱਚ ਵੀ ਟੋਇਲਟ ਅਤੇ ਬਾਥਰੂਮ ਵੀ ਬਣਾ ਰਹੇ ਹਨ ਦੇਖਿਆ ਜਾਵੇ ਤਾਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਬਿਮਾਰੀਆਂ ਦੀਆਂ ਗਿਣਤੀ ਬਹੁਤ ਘੱਟ ਹੋ ਸਕਦੀ ਹਨ